ਮੇਰੇ ਵੱਲੋਂ ਸ਼ੋਸ਼ਲ ਮੀਡੀਆ 'ਤੇ ਕੋਈ ਵੀ ਤਸਵੀਰ ਪੋਸਟ ਨਹੀਂ ਕੀਤੀ ਜਾਂਦੀ ਹੈ ਨਾ ਹੀ ਫੇਸਬੁੱਕ 'ਤੇ ਨਾ ਹੀ ਕਿਸੇ ਵਟਸਐਪ ਅਤੇ ਮੈਂ ਆਪਣੀ ਤਸਵੀਰ ਪੋਸਟ ਕਰਦਾ ਹਾਂ ਨਾ ਹੀ ਕਰਨਾ ਚਾਹਵਾਂਗਾ